ਸਫਰੀਂਗ ਇੱਕ ਵਾਟਰ ਸਪੋਟ ਹੈ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਇਸ ਬਾਰੇ ਜ਼ਿਆਦਾ ਪਤਾ ਨਹੀਂ ਹੈ ਪ੍ਰੰਤੂ ਜਿੱਥੇ ਤੱਕ ਮੈਂ ਜਾਣਦੀ ਹਾਂ ਵੈੱਟ ਸੂਟ ਪੈਡਲ ਟਨਨ ਟ੍ਰੇਨਰ ਦੀ ਵੱਧ ਤੋਂ ਵੱਧ ਜ਼ਰੂਰਤ ਪੈਂਦੀ ਹੈ ਕਿਉਂਕਿ ਸਾਨੂੰ ਇਹ ਗਾਈਡ ਕਰਦਾ ਹੈ ਤਾਂ ਜੋ ਸਾਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋ ਸਕੇ